ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਨਾ ਅਸੀਂ ਕਿਤਾਬਾਂ ਲੈਣੀਆਂ ਜੀ ਪੁਰਾਣੀਆਂ ਬੱਚ ਬੱਚਿਆਂ ਵਾਸਤੇ ਅਸੀਂ ਦਸਵੀਂ ਕਲਾਸ ਦੀਆਂ ਪੁਰਾਣੀਆਂ ਲੈਣੀਆਂ ਜੀ ਹਾਂਜੀ ਹਾਂਜੀ ਹਾਂਜੀ ਅੱਧ ਮੁੱਲ 'ਤੇ ਜੀ ਦਸਵੀਂ ਕਲਾਸ ਦੀਆਂ ਦੇ ਦਿਓ ਇੱਕ ਤਾਂ ਦੇ ਦਿਓ ਮੈਥ ਦੀ ਪੰਜਾਬੀ ਅਤੇ ਅੰਗਰੇਜ਼ੀ ਹਾਂਜੀ ਹਾਂਜੀ ਪੰਜਾਬ ਬ ਬੋਰਡ ਦੀਆਂ ਹਾਂਜੀ ਤਿੰਨ ਤਿੰਨਾਂ ਸਬਜੈਕਟਾਂ ਦੀਆਂ ਹੋਗੀਆਂ ਜੀ ਹਾਂ ਤਿੰਨ ਸਬਜੈਕਟਾਂ ਦੀਆਂ ਹੋਗੀਆਂ ਹਾਂਜੀ ਇਹ ਕਰ ਦਿਓ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਇੱਕ ਸਾਨੂੰ ਤੁਸੀਂ ਪੰਜਵੀਂ ਕਲਾਸ ਦੀਆਂ ਵੀ ਦੇ ਦਓ ਨਹੀਂ ਓ ਮਤਲਬ ਉਹ ਪਜ ਪੰਜਵੀਂ ਕਲਾਸ ਦੀ ਇਕੱਲੀ ਮੈਥ ਦੀ ਚਾਹੀਦੀ ਜੀ ਹਾਂਜੀ ਮੈਥ ਦੀ ਦਓ ਹੈਂ ਉਹ ਵੀ ਦੇਖ ਲਓ ਅੱਛਾ ਸੋਮਵਾਰ ਮੰਗਵਾ ਕੇ ਦਓਗੇ ਜੀ ਠੀਕ ਹੈ ਚੱਲ ਸੋਮਵਾਰ ਮੰਗਾ ਦਿਓ ਜੀ ਇੱਕ ਸਾਨੂੰ ਦੋ ਰਜਿਸਟਰ ਵੀ ਦੇ ਦੇਣਾ ਪੰਜਾਹ ਵਾਲਾ ਜੀ ਹਾਂਜੀ ਅੱਛਾ ਠੀਕ ਹੈ ਜੀ ਦੋ ਰਜਿਸਟਰ ਦੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਦੋ ਰਜਿਸਟਰ ਕਰ ਦਿਓ ਜੀ ਠੀਕ ਹੈ ਠੀਕ ਅ ਅਤੇ ਨਾ ਸਾਡੇ ਘਰ ਨਾ ਪੁਰਾਣੀਆਂ ਕਿਤਾਬਾਂ ਪਈਆਂ ਹੋਈਆਂ ਅਤੇ ਦੇ ਜਾਵਾਂਗੇ ਅਸੀਂ ਹੈਂ ਲੈ ਲਓਗੇ ਨਾ

ਠੀਕ ਹੈ ਚਲੋ ਜੀ ਸਾਡੇ ਕੋਲ ਮਤਲਬ ਅੱਠਵੀਂ ਦੀਆਂ ਪਈਆਂ ਹੈ ਅਤੇ ਛੇਵੀਂ ਦੀਆਂ ਪਈਆਂ ਹੋਈਆਂ ਹੈ ਸੱਤਵੀਂ ਦੀਆਂ ਵੀ ਤਾਂ ਤੁਹਾਨੂੰ ਉਹ ਦੇ ਦਿਆਂਗੇ ਜੀ ਅਸੀਂ ਜੀ ਹਾਂ ਹਾਂਜੀ ਨਹੀਂ ਨਹੀਂ ਉਣੇ ਕੁ ਟੈਮ ਨਾਲ ਈ ਦੇ ਜਾਵਾਂਗੀ ਹਾਂ ਹਾਂਜੀ ਹਾਂਜੀ ਅਤੇ ਤੁਹਾਡੇ ਕੋਲ ਜਮੈਟਰੀ ਜਿਹੜੀ ਬੱਚੇ ਪਾਉਂਦੇ ਪਿਨਸਲਾਂ ਰਬੜਾਂ ਉਹ ਵੀ ਮਿਲ ਜਾਏਗੀ ਤੁਹਾਡੇ ਕੋਲੋਂ ਸਾਨੂੰ ਜਮੈਟਰੀ ਦੇ ਦਿਓ ਇੱਕ ਜੀ ਹਾਂਜੀ ਜੀ ਅਸੀਂ ਰਹਿ ਬੱ ਸੱਤਵੀਂ ਜਮਾਤ ਦਾ ਬੱਚਾ ਜੀ ਹਾਂਜੀ ਨਹੀਂ ਜੀ ਸਾਰਾ ਸਮਾਨ ਹੁੰਦਾ ਨਾ ਉਹ ਦੇ ਦੇਣਾ ਹੀ ਜੀ ਡੇਢ ਸੌ ਵਾਲੀ ਕਰ ਦਿਓ ਹਾਂਜੀ ਅਤੇ ਪਿਨ ਵਗੈਰਾ ਵੀ ਹੈਗੇ ਜੀ ਅੱਛਾ ਪੈਨ ਕ ਪੈੱਨ ਵੀ ਕਰ ਦਿਓ ਜੀ ਚਾਟ ਵੀ ਦਿਓ ਇਕ ਚਾਟ ਪਿਨ ਸਾਨੂੰ ਕਰ ਦਿਓ ਦੋ ਪੈਨ ਕਰ ਦਿਓ ਜੀ ਬਲਯੂ ਬਲਯੂ ਬਲਯੂ ਬਲਯੂ ਚਾਹੀਦਾ ਹੈ ਹਾਂਜੀ ਦੋਵੇਂ ਚਾਹੀਦੇ ਜੀ ਦੋ ਦੇ ਦਿਓ ਓਹ ਵੀ ਹਾਂਜੀ ਚਾ ਚਾਟ ਚਾਟ ਜੀ ਚੋਕ ਆਪਾਂ ਕੀ ਕਰਨੇ ਚਾਟ ਹਾਂਜੀ ਵਾਈਟ ਚਾਹੀਦਾ ਹਾਂਜੀ ਅੱਛਾ ਦੇਖ਼ ਲਓ ਦੇਖ ਲਓ ਕੋਈ ਗੱਲ ਨਹੀਂ ਹਾਂ ਠੀਕ ਪੈਸੇ ਬਣਾਓ ਜੀ ਹੁਣ ਹਾਂਜੀ ਹਾਂਜੀ ਅੱਛਾ ਤਿੰਨ ਸੌ ਦੇ ਉੱਤੇ ਬਣੇ ਜੀ ਹਾਂਜੀ ਕੋਈ ਗੱਲ ਨਹੀਂ ਧੰਨਵਾਦ ਜੀ